ਕੋਈ ਵੀ ਚਿੱਤਰ ਤਿਆਰ ਕਰਨ ਲਈ ਸਾਨੂੰ ਪਹਿਲਾਂ ਇੱਕ ਪੇਜ ਦੀ ਲੋੜ ਪੈਂਦੀ ਹੈ ਜਿਸ 'ਤੇ ਅਸੀਂ ਕਿਸੇ ਚੀਜ਼ ਨੂੰ ਵੀ ਡਰਾਅ ਕਰ ਸਕਦੇ ਹਾਂ ਅਤੇ ਉਸ ਵਿੱਚ ਸਾਨੂੰ ਰੰਗ ਭਰਨ ਲਈ ਬਰਸ਼ ਕਲਰਸ ਦੀ ਲੋੜ ਪੈਂਦੀ ਹੈ ਅਤੇ ਪੇਂਟ ਕਲਰ ਨੂੰ ਸਾਨੂੰ ਰੱਖਣ ਵਾਸਤੇ ਇੱਕ ਟਰੇ ਦੀ ਲੋੜ ਪੈਂਦੀ ਹੈ ਜਿਸ ਵਿੱਚ ਅਸੀਂ ਕਲਰ ਨੂੰ ਰੱਖ ਸਕਦੇ ਹਾਂ ਅਤੇ ਬੜੀ ਆਸਾਨੀ ਨਾਲ ਪੇਂਟਿੰਗ ਕਰ ਸਕਦੇ ਹਾਂ ਅਤੇ ਇਸ 'ਚ ਸਾਨੂੰ ਕੋਈ ਤਕਲੀਫ ਵੀ ਨਹੀਂ ਹੋਵੇਗੀ ਅਤੇ ਸਾਨੂੰ ਪੇ ਡਰਾਅ ਕਰਨ ਵਾਸਤੇ ਸਾਨੂੰ ਪੈਂਸਿਲ ਰਬੜ ਦੀ ਵੀ ਲੋੜ ਪੈਂਦੀ ਹੈ ਅਤੇ ਮੈਨੂੰ ਡਰਾਇੰਗ ਦਾ ਬਹੁਤ ਹੀ ਸ਼ੌਕ ਹੈ ਮੈਂ ਬਚਪਨ ਤੋਂ ਹੀ ਡਰਾਇੰਗ ਸਿੱਖਣ ਵਿੱਚ ਦਿਲਚਸਪੀ ਰੱਖਦੀ ਸੀ ਅਤੇ ਮੈਂ ਡਰਾਇੰਗ ਸਿੱਖੀ ਹੈ ਅਤੇ ਹੁਣ ਵੀ ਮੈਂ ਡਰਾਇੰਗ ਕਰ ਕਰਦੀ ਹਾਂ ਅਤੇ ਕੋਈ ਵੀ ਚੀਜ਼ ਨੂੰ ਮੈਂ ਜਿਹੜੀ ਸਾਹਮਣੇ ਪਈ ਹੋਏ ਕੋਈ ਵੀ ਚੀਜ਼ ਨੂੰ ਮੈਂ ਹੂਬਹੂ ਬਣਾ ਸਕਦੀ ਹਾਂ ਦੇਖ ਕੇ ਉਸ ਚੀਜ਼ ਨੂੰ ਡਰਾਅ ਕਰ ਸਕਦੀ ਹਾਂ ਅਤੇ ਇਸ ਮੈਨੂੰ ਹਮੇਸ਼ਾ ਤੋਂ ਮੇਰਾ ਸੁਪਨਾ ਹੈ ਕਿ ਮੈਂ ਡਰਾਇੰਗ ਕਰਾਂ ਮੈਂ ਆਪਣੀ ਫੈਮਿਲੀ ਦੀ ਫੋਟੋ ਤਿਆਰ ਕੀਤੀ ਹੈ ਜਿਸ ਵਿੱਚ ਮੈਂ ਡਰਾਇੰਗ ਕੀਤੀ ਹੈ ਆਪਣੀ ਪੂਰੀ ਫੈਮਿਲੀ ਦੀ ਅਤੇ ਹੂਬਹੂ ਧੰਨਵਾਦ